ਪੰਜਾਬ ਵਿੱਚ ਪ੍ਰਸਿੱਧ ਬੀਚ ਪੰਜਾਬ ਵਿੱਚ ਪ੍ਰਸਿੱਧ ਬੀਚ ਤਾਂ ਕੋਈ ਨਹੀਂ ਹੈ ਕਿਉਂਕਿ ਜਿੱਥੇ ਆਕਰ ਸੈਲਾਨੀ ਤੈਰਾਕੀ ਸੂਰਿਆ ਇਸ਼ਨਾਨ ਜਾਂ ਪਾਣੀ ਦੀਆਂ ਖੇਡਾਂ ਖੇਡ ਸਕਣ ਬਲਕਿ ਇੱਥੇ ਤਾਂ ਕੋਈ ਵੀ ਪੰਜਾਬ ਦੇ ਅੰਦਰ ਕੋਈ ਸਮੁੰਦਰ ਤੱਟ ਵੀ ਨੇੜੇ ਨਹੀਂ ਲੱਗਦਾ ਅਤੇ ਨਾ ਹੀ ਕੋਈ ਪੰਜਾਬ ਦੇ ਅੰਦਰ ਝੀਲ ਹੈ ਜਿੱਥੇ ਇਸ ਤਰ੍ਹਾਂ ਦਾ ਕੋਈ ਖੇਡਾਂ ਹੋ ਸਕਣ ਹਾਂ ਕੁਛ ਰਿਸੋਰਟ ਹੋ ਸਕਦੇ ਹਨ ਜਿਨ੍ਹਾਂ ਨੇ ਆਪਣਾ ਅਲੱਗ ਤੋਂ ਇਸ ਤਰ੍ਹਾਂ ਦੇ ਬੀਚ ਬਣਾਏ ਹੋਣ ਪਰ ਉੱਥੇ ਖੇਡਾਂ ਨਹੀਂ ਹੋ ਸਕਦੀਆਂ ਤੈਰਾਕੀ ਵਾਸਤੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਹਨ ਜਿਹੜੇ ਉਹਨਾਂ 'ਚ ਰਿਜੋਰਟ 'ਚ ਆ ਕੇ ਰਹਿੰਦੇ ਹਨ ਉਹ ਹੀ ਇਸਦਾ ਲੁਤਫ ਉਠਾਉਂਦੇ ਹੋਣਗੇ ਪੰਜਾਬ ਦੇ ਵਿੱਚ ਦੂਰ ਦੂਰ ਤੱਕ ਇਹੋ ਜਿਹਾ ਕੋਈ ਵੀ ਨਹੀਂ ਹੈਗਾ ਜਿੱਥੇ ਇਸ ਤਰ੍ਹਾਂ ਦਾ ਕੋਈ ਕਾਰਾ ਹੋ ਸਕੇ ਹਾਂ ਇੱਥੇ ਕੁਛ ਸਰੋਵਰ ਹਨ ਪਰ ਉਹ ਧਾਰਮਿਕ ਹੋਣ ਕਰਕੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਬਲਕਿ ਉਹ ਸ਼ਰਧਾਲੂ ਜਾ ਕੇ ਉੱਥੇ ਇਸ਼ਨਾਨ ਕਰਦੇ ਹਨ ਅਤੇ ਆਪਣੇ ਮਨ ਦੀ ਸੰਤੁਸ਼ਟੀ ਪਾਉਂਦੇ ਹਨ ਜਿਨ੍ਹਾਂ ਦੇ ਨਾਲ ਕੁਛ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਸੋ ਇਸ ਕਰਕੇ ਪੰਜਾਬ ਦੇ ਅੰਦਰ ਕੋਈ ਵੀ ਐਸਾ ਪ੍ਰਸਿੱਧ ਬੀਚ ਨਹੀਂ ਹੈ ਜਿੱਥੇ ਸੈਲਾਨੀ ਆ ਕੇ ਸੂਰਿਆ ਇਸ਼ਨਾਨ ਕਰਨ ਜਾਂ ਪੰਜਾਬ ਦੀਆਂ ਖੇਡਾਂ ਹੋ ਸਕਣ